ਮੇਰਾ ਨਾਮ ਨੰਦਨੀ ਹੈ ਮੈਂ ਆਪਣੀ ਗਾਇਕੀ ਦੀ ਤਕਨੀਕੀ ਦਾ ਅਭਿਆਸ ਅਤੇ ਉਸ ਦੇ ਕੰਮ ਘਰ ਵਿੱਚ ਹੀ ਕਰਦੀ ਹਾਂ ਜਿਵੇਂ ਕਿ ਇੰਗਲਿਸ਼ ਪੰਜਾਬੀ ਹਿੰਦੀ ਸੌਂਗ ਮੈਂ ਲਿਰਿਕਸ ਵਿੱਚ ਪੜ੍ਹਦੀ ਹਾਂ ਪਹਿਲਾਂ ਫਿਰ ਉਸ ਤੋਂ ਬਾਅਦ ਉਸਨੂੰ ਉਸ ਲਹਿਜ਼ੇ ਵਿੱਚ ਗਾ ਕੇ ਵੇਖਦੀ ਹਾਂ ਫਿਰ ਇੱਕ ਸੌਂਗ ਜਿਹੜਾ ਕਿ ਮੈਂ ਹਰ ਰੋਜ਼ ਰਿਪੀਟ ਕਰਦੀ ਰਹਿੰਦੀ ਹਾਂ ਸੁਰ ਲਗਾ ਕੇ ਦੇਖਦੀ ਰਹਿੰਦੀ ਹਾਂ ਅਤੇ ਅਲੱਗ ਅਲੱਗ ਤਰ੍ਹਾਂ ਦੇ ਮੈਂ ਸੌਂਗ ਗਾਣੇ ਗਾਇਕੀ ਗਾ ਕੇ ਪ੍ਰਦਰਸ਼ਨ ਸਟੇਜਾਂ ਉੱਤੇ ਕਰਦੀ ਹਾਂ ਬਹੁਤ ਤਰ੍ਹਾਂ ਦੇ ਮੈਂ ਗਾਣੇ ਗਾਏ ਹੋਏ ਹਨ ਅਤੇ ਮੈਂ ਗਾਉਣਾ ਵੀ ਚਾਹੁੰਦੀ ਹਾਂ ਕਈ ਵਾਰ ਮੇਰੇ ਗਲਾ ਖਰਾਬ ਹੋਣ ਕਰਕੇ ਮੈਂ ਸੁਰ ਨਹੀਂ ਲਗਾ ਪਾਉਂਦੀ ਫਿਰ ਇਸ ਤਰ੍ਹਾਂ ਮੈਂ ਆਪਣਾ ਸੁਰ ਲਗਾਉਣ ਵਾਸਤੇ ਜਾਂ ਗਲਾ ਸਾਫ ਕਰਨ ਵਾਸਤੇ ਮੈਂ ਗਰਮ ਪਾਣੀ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ ਨਿੱਘਾ ਜਿਹਾ ਪਾਣੀ ਕਰਕੇ ਉਹਨੂੰ ਪੀਂਦੀ ਹਾਂ ਤਾਂ ਕਿ ਮੇਰਾ ਗਲਾ ਸਾਫ ਹੋ ਜਾਵੇ ਇਸ ਤਰ੍ਹਾਂ ਮੈਂ ਆਪਣੀ ਗਾਇਕੀ ਪ੍ਰਦਰਸ਼ਨ ਤਕਨੀਕ ਦਾ ਅਭਿਆਸ ਕਰਦੀ ਹਾਂ ਅਤੇ ਰੋਜ਼ਾਨਾ ਕਰਦੀ ਹਾਂ ਮੈਨੂੰ ਬਹੁਤ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਘਰ ਵਿੱਚ ਜਦੋਂ ਕੋਈ ਸ਼ੋਰ ਸ਼ਰਾਬਾ ਹੁੰਦਾ ਹੈ ਤਾਂ ਮੈਂ ਨਹੀਂ ਗਾ ਪਾਉਂਦੀ ਜਾਂ ਘਰ ਦੇ ਵਿੱਚ ਕੋਈ ਫੰਕਸ਼ਨ ਹੁੰਦੇ ਹਨ ਤਾਂ ਮੈਂ ਆਪਣੀ ਗਾਇਕੀ ਦਾ ਅਭਿਆਸ ਤਕਨੀਕ ਦਾ ਅਭਿਆਸ ਨਹੀਂ ਕਰ ਪਾਉਂਦੀ ਇਸ ਤਰ੍ਹਾਂ ਫਿਰ ਜਦੋਂ ਘਰ ਵਿੱਚ ਕੋਈ ਨਹੀਂ ਹੁੰਦਾ ਉਸ ਦੌਰਾਨ ਮੈਂ ਆਪਣੀ ਗਾਇਕੀ ਦਾ ਅਭਿਆਸ ਕਰਦੀ ਹਾਂ ਅਤੇ ਜਦੋਂ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਇਹ ਗਾਣਾ ਗਾ ਸਕਦੀ ਹਾਂ ਫਿਰ ਮੈਂ ਸਟੇਜ ਉੱਤੇ ਉਹ ਪ੍ਰਦਰਸ਼ਨ ਕਰਕੇ ਆਉਂਦੀ ਹਾਂ ਅਤੇ ਇੱਕ ਵਾਰੀ ਮੈਨੂੰ ਆਪਣੀ ਗਾਇਕੀ ਦੇ ਦੌਰਾਨ ਸੈਕਿੰਡ ਪ੍ਰਾਈਜ਼ ਵੀ ਮਿਲਿਆ ਸੀ ਮੈਂ ਹੀਰ ਗਾਈ ਸੀ ਅਤੇ ਇੱਕ ਵਾਰੀ ਮਿਰਜ਼ਾ ਰਾਂ ਮਿਰਜ਼ਾ ਸਾਹਿਬਾ ਵੀ ਗਾਇਆ ਸੀ ਥੈਂਕ ਯੂ